ਪ੍ਰਾਰਥਨਾਵਾਂ ਵਿੱਚ ਸੱਚ ਬੋਲਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਤੁਹਾਨੂੰ ਸਹਾਰਾ ਦੇਣ ਵਿੱਚ ਮਦਦ ਕਰਦੀ ਹੈ ਅਤੇ ਤੁਹਾਨੂੰ ਸ਼ਾਂਤੀ ਅਤੇ ਸਕੂਨ ਦੇ ਅਨੁਭਵ ਕਰਵਾਉਂਦੀ ਹੈ ਅਰਦਾਸਾਂ ਵਿੱਚ ਝੂਠ ਬੋਲਣਾ ਕਿਸੇ ਨੂੰ ਠੱਗਣ ਵਾਲਾ ਅਨੁਭਵ ਦਵਾ ਸਕਦਾ ਹੈ ਅਤੇ ਉਸ ਦੀ ਸਥਿਤੀ ਨੂੰ ਵਿਅਕਤੀ ਨੂੰ ਸਹੀ ਸਮਝਣ ਵਿੱਚ ਰੁਕਾਵਟ ਪੈ ਸਕਦੀ ਹੈ ਕਈ ਵਾਰ ਅਸੀਂ ਪ੍ਰਾਰਥਨਾਵਾਂ ਵਿੱਚ ਕਈ ਕਿਸਮ ਦੇ ਬਹਾਨੇ ਬਣਾਉਂਦੇ ਹਾਂ ਕਈ ਵਾਰ ਅਸੀਂ ਪਾਠ ਨੂੰ ਜ਼ਿਆਦਾ ਵੱਡਾ ਹੋਣ ਕਰਕੇ ਅਸੀਂ ਕਈ ਵਾਰ ਟਾਲ ਦਿੰਦੇ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਕੋਈ ਨਾ ਥੋੜ੍ਹੀ ਦੇਰ ਬਾਅਦ ਕਰਦੇ ਹਾਂ ਇਹ ਹੀ ਸਭ ਕਹਿ ਕੇ ਅਸੀਂ ਟਾਲ ਦਿੰਦੇ ਹਾਂ ਉਪਾਸਨਾ ਬਾਰੇ ਝੂਠ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਸਹੀ ਸੰਦੇਸ਼ ਜਾਣਦੇ ਹੋ ਹਰ ਸਮੇਂ ਸੱਚਾਈ ਅਤੇ ਇਮਾਨਦਾਰੀ ਨੂੰ ਪਸੰਦ ਕਰਦੇ ਹੋ